ਉਂਝ ਸਾਡੇ ਇੱਥੇ ਸ਼ਹਿਰ ਦੇ ਵਿੱਚ ਬਹੁਤ ਸਾਰੀ ਏਦਾਂ ਦੀ ਉਦਾਹਰਨ ਯੋਗ ਚੀਜ਼ਾਂ ਨੇ ਜਿਵੇਂ ਕਿ ਸਾਡੇ ਇੱਥੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਮਿਲਦਾ ਟਿੱਬੀ ਸਾਹਿਬ ਹੋ ਗਿਆ ਭੱਠਾ ਸਾਹਿਬ ਜਿਹੜੇ ਬਹੁਤ ਪ੍ਰਚਲਿਤ ਹਨ ਬਹੁਤ ਸਾਰੇ ਲੋਕ ਇੱਥੇ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਹਨ ਔਰ ਇਹ ਬਹੁਤ ਫ਼ੇਮਸ ਵੀ ਆ ਸ਼ੁਰੂ ਤੋਂ ਹੀ ਕਿਉਂਕਿ ਇੱਥੇ ਸਾਡੇ ਜਿਹੜੇ ਗੁਰੂ ਸਾਹਿਬਾਨ ਆ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਦੂਜਾ ਇਹ ਹੈ ਕਿ ਸਾਡੇ ਇੱਕ ਜਿਹੜਾ ਇੱਥੇ ਸਤਲੁਜ ਦਰਿਆ ਹੈ ਉਹ ਵੀ ਬਹੁਤ ਫ਼ੇਮਸ ਹੈ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਵੀ ਅਤੇ ਬਹੁਤ ਸਾਰੇ ਇੱਥੇ ਜਿੱਦਾਂ ਕਿਸੇ ਦੀ ਮੈਰਿਜ਼ ਹੁੰਦੀ ਹੈ ਜਾਂ ਕੋਈ ਵੀ ਫਿਲਮ ਵ ਵ ਦਰਸਾਉਣੀ ਹੁੰਦੀ ਹੈ ਤਾਂ ਉੱਥੇ ਜਾ ਕੇ ਉਹ ਸ਼ੂਟਸ ਲੈਂਦੇ ਨੇ ਅਤੇ ਨਾਲ ਹੀ ਉੱਥੇ ਸਾਡੇ ਬੋਟਿੰਗ ਦਾ ਵੀ ਬਹੁਤ ਵਧੀਆ ਕੀਤਾ ਗਿਆ ਤਾਂ ਉਸਨੂੰ ਲੋਕ ਜ਼ਿਆਦਾ ਪਸੰਦ ਕਰਦੇ ਅਤੇ ਉੱਥੇ ਆ ਕੇ ਫੋਟੋਆਂ ਖਿੱਚਵਾਉਂਦੇ ਨੇ ਉੱਥੇ ਬੈਠਣਾ ਪਸੰਦ ਕਰਦੇ ਨੇ